ਹਾਂਜੀ ਮੇਰੀ ਨਿੱਜੀ ਇੱਛਾਵਾਂ ਬਟੀਕ ਦਾ ਕੰਮ ਹੈ ਸਿਲਾਈ ਕਢਾਈ ਦਾ ਕੰਮ ਜੋ ਕਿ ਮੈਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹਾਂ ਆਪਣਾ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਿੱਖ ਕੇ ਚਾਰ ਲੋਕਾਂ ਨੂੰ ਹੋਰ ਸਿੱਖਾਵਾਂ ਅਤੇ ਮੈਂ ਉਹ ਕੰਮ ਕਰ ਵੀ ਰਹੀ ਹਾਂ ਅਤੇ ਅੱਜ ਕੱਲ੍ਹ ਜੋ ਹੈ ਸਟੀਚਿੰਗ ਦੇ ਵਿੱਚ ਬਾਹਰ ਬਹੁਤ ਜ਼ਿਆਦਾ ਸਟੀਚਿੰਗ ਲੈ ਰਹੇ ਨੇ ਅਤੇ ਕਈ ਲੋਕ ਜੋ ਹੈ ਆਪਣੇ ਕੱਪੜੇ ਸਿਊਣ ਬਾਰੇ ਸੌ ਵਾਰੀ ਸੋਚਦੇ ਨੇ ਕਿ ਅਸੀਂ ਸਵਾਈਏ ਕਿ ਨਾ ਸਵਾਈਏ ਕਿਉਂਕਿ ਸ ਕੱਪੜਾ ਲੈਣ ਤੋਂ ਵੀ ਵੱਧ ਉਹਨਾਂ ਨੂੰ ਸਟਿਚਿੰਗ ਪੈ ਰਹੀ ਹੈ ਅਤੇ ਇਹ ਕੰਮ ਜਿਹੜਾ ਹੈ ਇਹ ਮਤਲਬ ਲੋਕਾਂ ਨੂੰ ਬਹੁਤ ਔਖਾ ਲੱਗ ਰਿਹਾ ਹੈ ਅਤੇ ਕਈ ਤਾਂ ਇਸੇ ਲਈ ਇਸ ਪਿੱਛੇ ਰੈਡੀਮੇਡ ਚੁੱਕ ਲੈਂਦੇ ਨੇ ਪਰ ਮੈਂ ਚਾਹੁੰਦੀ ਹਾਂ ਕਿ ਮੇਰੇ ਬੁਟੀਕ ਦੇ ਵਿੱਚ ਸਟੀਚਿੰਗ ਜੋ ਹੈ ਨੋਰਮਲ ਹੋਵੇ ਜਿਹ 'ਚ ਹਰ ਬੰਦਾ ਜੋ ਹੈ ਆਪਣੇ ਕੱਪੜੇ ਸਵਾ ਸਕੇ ਅਤੇ ਵਧੀਆ ਤੋਂ ਵਧੀਆ ਜੋ ਹੈ ਸਟਿਚਿੰਗ ਸਟਿਚ ਕੀਤੇ ਹੋਏ ਕੱਪੜੇ ਸਫਾਈ ਦੇ ਜਿਹੜੇ ਹੈ ਉਹ ਪ੍ਰਾਪਤ ਕਰ ਸਕੇ ਅਤੇ ਇਸ ਤੋਂ ਇਲਾਵਾ ਮੇਰਾ ਇਹ ਵੀ ਇੱਕ ਇੱਛਾਵਾਂ ਇੱਛਾ ਹੈਗੀ ਆ ਕਿ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਐਸੇ ਐਸੇ ਕੈਂਪ ਲਾਵਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਫ੍ਰੀ ਸਿਖਾਵਾਂ ਕਿਉਂਕਿ ਸਟੀਚਿੰਗ ਸ ਜਿਹੜੇ ਸਿੱਖਣ ਜਾਂਦੇ ਨੇ ਉਹਨਾਂ ਕੋਲ ਵੀ ਬਹੁਤ ਜ਼ਿਆਦਾ ਪੈਸੇ ਲੋਕ ਲੈ ਰਹੇ ਨੇ ਜੋ ਕਿ ਕਈ ਲੋਕ ਸਿੱਖਣ ਸਿੱਖਣਾ ਚਾਹੁੰਦੇ ਨੇ ਉਹਨਾਂ ਦੀ ਇੱਛਾਵਾਂ ਉਹਨਾਂ ਦੇ ਦਿਲ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਇਹੋ ਜਿਹੇ ਲੋਕਾਂ ਨੂੰ ਸਿੱਖਾਵਾਂ ਜਿਹੜੇ ਸੈਲਫ ਡਿਪੈਂਡ ਬਣਨ ਜਿੰਨੇ ਜਿਹੜੇ ਆਪਣੇ ਕੰਮ ਕਾਜ ਨੂੰ ਅੱਗੇ ਵਧਾ ਸਕਣ ਅਤੇ ਆਪਣੇ ਲਈ ਕੋਈ ਅਰਨਿੰਗ ਦਾ ਸਾਧਨ ਕਮਾਈ ਦਾ ਸਾਧਨ ਅੱਗੇ ਪ੍ਰਾਪਤ ਕਰ ਸਕਣ ਅਤੇ ਕਈ ਜਿਹੜੀ ਵਿਆਹੀ ਜਿੰਦ ਕੁਆਰੀਆਂ ਲੜਕੀਆਂ ਨੇ ਉਹ ਸਹੁਰੇ ਜਾ ਕੇ ਆਪਣਾ ਕਮਾਈ ਦਾ ਸਾਧਨ ਬਣਾ ਸਕਣ